ਹਾਂਜੀ ਅਸੀਂ ਕੱਪੜੇ ਬਣਾ ਰਹੇ ਹਾਂ ਵਧੀਆ ਬੱਚਿਆਂ ਦੇ ਅਸੀਂ ਨਿੱਕਰਾਂ ਬਣਾਉਂਦੇ ਹਾਂ ਬੱਚਿਆਂ ਦੀਆਂ ਪਿੱਛੇ ਪਲਾਸਟਿਕ ਪਾ ਕੇ ਮੂਹਰੇ ਬੈਲਟ ਕਰਕੇ ਵਲ ਪਾ ਕੇ ਉਹ ਨਾਲ ਜੇਬਾਂ ਲਗਾਉਂਦੇ ਹਾਂ ਜੇਬਾਂ ਲਾ ਕੇ ਫਿਰ ਬੱਚਿਆਂ ਦੇ ਅਸੀਂ ਛੋਟਿਆਂ ਦੇ ਉਹ ਪਾਉਂਦੇ ਹਾਂ ਅਸੀਂ ਪੈਂਟ ਵਾਂਗੂ ਵੀ ਉਵੇਂ ਜਿੱਕਰ ਕਟਾਈ ਕਰਦੇ ਆ ਕਟਾਈ ਕਰਕੇ ਮੁੰਡਿਆ ਬੱਚਿਆਂ ਲਈ ਅਸੀਂ ਪੈਂਟ ਵੀ ਪਾ ਦਿੰਦੇ ਹਾਂ ਅਤੇ ਕੁੜਤੇ ਪਜਾਮੇ ਵੀ ਪਾਉਂਦੇ ਹਾਂ ਉਹ ਵੀ ਕਟਾਈ ਕਰਕੇ ਬੱਚਿਆਂ ਦੀ ਬੰਗਾਲੀ ਕਮੀਜ਼ ਪਜਾਮੇ ਕੁੜਤੇ ਸਾਰੇ ਕਾਲਰਾਂ ਵਾਲੇ ਬੰਗਾਲੀ ਕਮੀਜ਼ ਇਹ ਸਾਰੇ ਬਣਾਏ ਆ ਛੋਟੀਆਂ ਬੱਚੀਆਂ ਦੀਆਂ ਫਰਾਕਾਂ ਉਹ ਜੀ ਅਸੀਂ ਬਣਾ ਕੇ ਬੱਚਿਆਂ ਦੀ ਬਿਲਟ ਵਾਲੀ ਫਰਾਕ ਅਤੇ ਕਲੀਆਂ ਵਾਲੀ ਫਰਾਕ ਅਤੇ ਰੇਵ ਫਰਾਕ ਇਹ ਅਸੀਂ ਬਣਾਈ ਹੈ ਜੀ ਬਣਾ ਕੇ ਇੱਕ ਅਸੀਂ ਬਣਾਈ ਸੀ ਜੀ ਫਰਾਕ ਇੱਕ ਬੱਚੀ ਲੈ ਕੇ ਗਈ ਦਸਵੀਂ 'ਚ ਫਰਾਕ ਅਤੇ ਉਹਨੂੰ ਬਹੁਤ ਵਧੀਆ ਇਨਾਮ ਮਿਲਿਆ ਵੀ ਇਹ ਫਰਾਕ ਕੈਸੀ ਬਣੀ ਹੈ ਬਹੁਤ ਅੱਛੀ ਬਣੀ ਸੀਗੀ ਜੀ ਉਹ ਬੱਚੀ ਨੂੰ ਫਿਰ ਇਨਾਮ ਮਿਲਿਆ ਛੋਟੀ ਜਿਹੀ ਬੱਚੀ ਦੀ ਅਸੀਂ ਫਰਾਕ ਬਣਾਈ ਸੀਗੀ ਉਹ ਸਾਨੂੰ ਬਹੁਤ ਵਧੀਆ ਲੱਗੀ ਜੀ ਬਹੁਤ ਸੋਹਣੀ ਬਣੀ ਸੀ ਇਹਨੂੰ